ਉੱਨੀ ਸੌ ਛਿਆਹਟ ਵਿੱਚ ਰਾਜਾਂ ਦਾ ਪੁਨਰ ਗਠਨ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਅਤੇ ਹਰਿਆਣਾ ਨੂੰ ਇੱਕ ਨਵੰਬਰ ਉੱਨੀ ਸੌ ਛਿਆਹਟ ਵਿੱਚ ਵੱਖ ਵੱਖ ਕਰ ਦਿੱਤਾ ਗਿਆ ਅਤੇ ਉਨ੍ਹਾਂ ਦਾ ਮੁੜ ਤੋਂ ਪੁਨਰਗਠਨ ਕੀਤਾ ਗਿਆ ਪੰਜਾਬ ਦੇ ਪੰਜ ਪੰਜਾਬ ਦੇ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਤਾ ਕੰਮਾਂ ਨੂੰ ਪੂਰੀ ਤਰ੍ਹਾਂ ਵੱਖੋ ਵੱਖਰਾ ਕਰ ਦਿੱਤਾ ਗਿਆ ਅਤੇ ਇਹ ਦ੍ਰਿਸ਼ ਇਹਨਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਪ੍ਰਸ਼ਾਸਨਿਕ ਕੰਮ ਵਿੱਚ ਹੀ ਦੋਵੇਂ ਰਾਜਾਂ ਦਾ ਪ੍ਰਸ਼ਾਸਨ ਵੱਖਰਾ ਵੱਖਰਾ ਚੱਲਣ ਲੱਗ ਗਿਆ ਅਤੇ ਰਾਜਨੀਤਿਕ ਤੌਰ 'ਤੇ ਵੀ ਇਹ ਦੋਨੋਂ ਰਾਜ ਵੱਖਰੇ ਵੱਖਰੇ ਕੰਮ ਕਰਨ ਲੱਗ ਪਏ ਇਸ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੋ ਅਲੱਗ ਅਲੱਗ ਰਾਜ ਬਣ ਗਏ ਸਨ ਇਹਨਾਂ ਦਾ ਪ੍ਰਭਾਵ ਲੋਕਾਂ ਦੇ ਉੱਪਰ ਦੇਖਣ ਨੂੰ ਬਹੁਤ ਮਾੜਾ ਪਿਆ ਹੈ ਅਤੇ ਹੁਣ ਅੱਜ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਦ੍ਰਿਸ਼ ਬਹੁਤ ਪ੍ਰਭਾਵਿਤ ਕਰਦਾ ਹੈ ਦੋਨੋਂ ਵੱਖਰੀ ਵੱਖਰੀ ਤੌਰ 'ਤੇ ਕੰਮ ਕਰ ਰਹੇ ਹਨ